ਮੈਨੂੰ ਨਹੀਂ ਲੱਗਦਾ ਕਿ ਭਾਰਤ ਵਿੱਚ ਕਲਾਕਾਰਾਂ ਨੂੰ ਮੌਕੇ ਅਤੇ ਮਹੱਤਵ ਨਹੀਂ ਦਿੱਤੇ ਜਾਂਦੇ ਹਨ ਕਿਉਂਕਿ ਕਲਾਕਾਰਾਂ ਨੂੰ ਕਲਾਕਾਰਾਂ ਅਤੇ ਮਹੱਤਵ ਲਈ ਬਹੁਤ ਸਾਰੇ ਸੈਮੀਨਾਰ ਲਗਾਏ ਜਾਂਦੇ ਹਨ